ਹਾਂਜੀ ਮੇਰੀ ਇੱਕ ਭਾਈ ਹੈਗੇ ਨੇ ਉਹ ਮੇਰੇ ਤੋਂ ਵੱਡੇ ਨੇ ਅਤੇ ਉਹਨਾਂ ਦਾ ਸੁਭਾਵ ਜਿਹੜਾ ਹੈ ਉਹ ਮੇਰੇ ਸੁਭਾਵ ਨਾਲ਼ ਥੋੜ੍ਹਾ ਬਹੁਤ ਮਿਲਦਾ ਜੁਲਦਾ ਹੀ ਜ਼ਿਆਦਾ ਅਲੱਗ ਨਹੀਂ ਹੈਗਾ ਉਹ ਵੀ ਸ਼ਾਂਤ ਸੁਭਾਵ ਦੇ ਹੈਗੇ ਨੇ ਅਤੇ ਮਿਲਨਸਾਰ ਨੇ ਅਤੇ ਬਾਕੀ ਜਿਹੜਾ ਉਹਨਾਂ ਦਾ ਰਹਿਣ ਸਹਿਣ ਹੈ ਉਹ ਕਾਫੀ ਅਲੱਗ ਹੈ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਦੀ ਲਾਈਫ ਬਿਜ਼ੀ ਹੈਗੀ ਹੈ ਉਹਨਾਂ ਨਾਲ਼ ਘੱਟ ਏ ਗੱਲਬਾਤ ਹੋ ਪਾਉਂਦੀ ਹੈ ਕਿਉਂਕਿ ਉਹ ਨੌਕਰੀ ਕਰਦੇ ਨੇ ਅਤੇ ਇਸ ਕਰਕੇ ਬਸ ਬਾਕੀ ਉਹਨਾਂ ਦਾ ਸੁਭਾਵ ਬਹੁਤ ਹੀ ਅੱਛਾ ਹੈ